ਹਾਂ ਆਪਾਂ ਅਗਰ ਵੀ ਕਿਸੇ ਵੀ ਸੰਸਥਾ ਦੇ ਨਾਲ ਜੁੜਨਾ ਹੋਵੇ ਤਾਂ ਹਾਂ ਆਪਾਂ ਬਹੁਤ ਸਾਰੇ ਇੱਦਾਂ ਦੇ ਜਿਵੇਂ ਕਿ ਵੀਡੀਓ ਕੋਂਨ ਫਰਸਿੰਗ ਐਪ ਦੀ ਦੀ ਵਰਤੋਂ ਕੀਤੀ ਹੈ ਅਗਰ ਆਪਾਂ ਇਗਜੈਂਮਪਲ ਲਿਤੀ ਜਾਵੇ ਤਾਂ ਆਪਾਂ ਜ਼ੂਮ ਐਪ ਦਾ ਜ਼ਿਆਦਾਤਰ ਯੂਜ ਕਰਦੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਘਰ ਬੈਠੇ ਹੀ ਇੱਕ ਦੂਜੇ ਦੀ ਸ਼ਕਲ ਵਗੈਰਾ ਦੇਖ ਕੇ ਗੱਲਬਾਤ ਵਗੈਰਾ ਆਪਾਂ ਕਰ ਸਕਦੇ ਹਾਂ ਆਪਾਂ ਹੋਰ ਵੀ ਵੀਡੀਓ ਇੱਦਾਂ ਜਿੱਦਾਂ ਵੀਡੀਓ ਕੋਲ ਦੀ ਵੀ ਆਪਾਂ ਯੂਜ਼ ਕਰ ਸਕਦੇ ਹਾਂ ਵੀਡੀਓ ਕੋਂਨਫਰੈਂਸਿੰਗ ਵਿੱਚ ਕੀ ਹੁੰਦਾ ਕਿ ਜਿਵੇਂ ਕਿ ਅਗਰ ਤਾਂ ਆਪਾਂ ਜਿਵੇਂ ਸਕੂਲ ਸਿੱਖਿਆ ਦੀ ਅਗਰ ਆਪਾਂ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਸਾਨੂੰ ਘਰ ਬੈਠੇ ਔਨਲਾਈਨ ਸ਼ਿਕਸ਼ਾ ਦਿੱਤੀ ਜਾਂਦੀ ਹੈ ਜਦੋਂ ਸਾਡੇ ਕਰੋਨਾ ਚੱਲ ਰਿਹਾ ਸੀ ਉਦੋਂ ਕੀ ਸੀ ਸਾਡੀ ਜਿੰਨੀ ਵੀ ਮੀਟਿੰਗਸ ਵਗੈਰਾ ਹੁੰਦੀਆਂ ਸੀ ਉਹ ਸਾਰੇ ਜੂਮ ਐਪ 'ਤੇ ਹੁੰਦੇ ਸੀ ਵੀਡੀਓ ਕੋਂਨਫਰੈਂਸਿੰਗ ਐਪ 'ਤੇ ਹੁੰਦੀਆਂ ਸਨ ਉੱਥੇ ਹੀ ਸਾਨੂੰ ਸਾਰੇ ਆਪਣੇ ਸ਼ਿਕਸ਼ਾ ਵਗੈਰਾ ਪੜ੍ਹਾਈ ਦਿੱਤੀ ਜਾਂਦੀ ਸੀ ਸਾਨੂੰ ਪੜ੍ਹਾਇਆ ਜਾਂਦਾ ਸੀ ਅਗਰ ਤਾਂ ਸਾਡੇ ਕੋਈ ਵੀ ਡਾਊਟ ਹੁੰਦੇ ਸੀ ਜਾਂ ਮੁਸ਼ਕਿਲਾਵਾਂ ਆਉਂਦੀਆਂ ਹੁੰਦੀਆਂ ਸਨ ਸਾਨੂੰ ਉਸੇ ਹੀ ਐਪ 'ਤੇ ਸਾਡੇ ਕੋਲ ਪੁੱਛ ਲਿੱਤਾ ਜਾਂਦਾ ਹੁੰਦਾ ਸੀਗਾ ਤਾਂ ਮਤਲਬ ਇਹ ਸੀਗਾ ਕਿ ਆਪਾਂ ਘਰ ਬੈਠੇ ਵੀ ਪੜ੍ਹ ਸਕਦੇ ਹਾਂ ਅਗਰ ਤਾਂ ਸਾਡਾ ਕੋਈ ਰਿਸ਼ਤੇਦਾਰ ਕਿਸੇ ਫੋਰਨ ਕ ਜਗ੍ਹਾ 'ਤੇ ਬੈਠਾ ਹੋਇਆ ਆਪਾਂ ਕੀ ਕਰਦੇ ਹਾਂ ਅਗਰ ਸਾਡਾ ਦਿਲ ਹੋਵੇ ਆਪਾਂ ਉਹਨਾਂ ਨੂੰ ਦੇਖਣਾ ਚਾਹੁੰਦੇ ਤਾਂ ਆਪਾਂ ਕੀ ਕਰਦੇ ਹਾਂ ਵੀਡੀਓ ਕੋਂਨਫਰੈਂਸਿੰਗ ਐਪ ਦਾ ਯੂਜ ਕਰਦੇ ਹਾਂ ਕਿ ਹਾਂ ਸਾਨੂੰ ਲੱਗਦਾ ਕਿ ਉਹ ਇਨਸਾਨ ਸਾਡੇ ਕੋਲ ਹੀ ਬੈਠਾ ਹੋਇਆ ਅਤੇ ਆਪਾਂ ਉਹਦੇ ਨਾਲ ਹਰ ਤਰ੍ਹਾਂ ਦੀ ਗੱਲ ਕਰ ਲਿੱਤੀ ਜਾਂਦੇ ਹਨ ਇਹ ਸਾਡੇ ਲਈ ਬਹੁਤ ਹੀ ਇੱਕ ਤਰ੍ਹਾਂ ਦਾ ਵਧੀਆ ਹੀ ਪਸੰਦ ਵਾਲਾ ਐਪ ਹੈਗਾ ਨਾਪਸੰਦ ਦੀ ਤਾਂ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਹੈਗੀ ਬਟ ਅੱਜ ਕੱਲ੍ਹ ਦੀ ਜਨਰੇਸ਼ਨ ਇਹਦਾ ਗਲਤ ਯੂਜ ਕਰਦੀ ਆ ਕਿ ਕੋਈ ਕਿਸੇ ਦੇ ਨਾਲ ਵੀਡੀਓ ਕੋਂਨਫਰੈਂਸਿੰਗ 'ਤੇ ਗੱਲ ਕਰਦਾ ਹੈ ਤਾਂ ਉਹਦੀ ਸਕਰੀਨਸ਼ੋਟ ਵਗੈਰਾ ਲੈ ਲਿੱਤਾ ਜਾਂਦਾ ਹੈ ਕਿ ਇਹ ਸਭ ਚੀਜ਼ਾਂ ਨੇ ਅਦਰਵਾਈਜ਼ ਸਭ ਕੁਛ ਵਧੀਆ ਹੀ ਹੈ